ਹਾਂਜੀ ਹਾਂਜੀ ਕੋਮਲ ਅੱਛਾ ਜੀ ਅੱਛਾ ਅੱਛਾ ਅੱਛਾ ਕੀ ਕਰਦੇ ਤੁਸੀਂ ਦੋਵੇਂ ਹਾਂਜੀ ਹਾਂਜੀ ਠੀਕ ਹੈ ਨਹੀਂ ਆ ਹੁਸ਼ਿਆਰਪੁਰ ਬਸ ਹੁਣ ਆ ਜਿੱਦਾਂ ਸਰਦੀਆਂ ਦਾ ਮੌਸਮ ਆ ਅਤੇ ਧੁੰਦ ਵਗੈਰਾ ਬਹੁਤ ਹੁੰਦੀ ਆ ਠੰਡ ਜ਼ਿਆਦਾ ਪੈਂਦੀ ਮਤਲਬ ਓਧਰ ਨਾਲੋਂ ਕੰਪੈਰੀਜਨ ਲਾ ਲਓ ਅਤੇ ਹਾਂਜੀ ਹਾਂਜੀ ਓਧਰ ਤਾਂ ਇੰਨੀ ਨਹੀਂ ਪੈਂਦੀ ਮਤਲਬ ਗਰਮੀਆਂ ਹੀ ਹੁੰਦੀਆਂ ਹੈ ਇੱਧਰ ਸਈ ਹੈ ਮੌਸਮ ਇੱਥੇ ਵੀ ਵਧੀਆ ਆ ਅਤੇ ਤੁਸੀਂ ਇੱਥੇ ਹੁਣ ਰਹਿਣ ਆਉਣਾ ਆ ਕਿੱਥੇ ਹੋਏ ਸ਼ਿਫਟ ਅੱਛਾ ਅੱਛਾ ਅਤੇ ਇੱਥੇ ਕਿਸ ਸਾਈਡ ਕਿਹੜੀ ਸਾਈਡ ਹੁਸ਼ਿਆਰਪੁਰ ਠੀਕ ਹੈ ਹੂੰ ਮੈਂ ਫਿਰ ਖੰਨਾ ਰੋਡ ਪੀ ਆਰ ਟੀ ਸੀ ਹੂੰ ਸਹੀ ਹੈ ਨੇਚਰ ਵਗੈਰਾ ਉਨ੍ਹਾਂ ਦੇ ਕੰਪੈਰੀਜਨ ਨਾਲੋਂ ਤਾਂ ਬਹੁਤ ਵਧੀਆ ਆ ਬਸ ਉੱਥੇ ਠੰਡ ਜ਼ਿਆਦਾ ਪੈਂਦੀ ਗਰਮੀ ਨਹੀਂ ਹੁੰਦੀ ਐਨੀ ਹੂੰ ਨਹੀਂ ਤੁਸੀਂ ਹਜੇ ਤਾਂ ਠੰਡਾਂ ਦੇ ਕੱਪੜੇ ਲੈ ਲਓ ਸਮਰਸ ਤਾਂ ਹਜੇ ਬਹੁਤ ਦੂਰ ਆ ਹਜੇ ਮਹੀਨਾ ਪੈਣੀ ਆ ਠੰਡ ਧੁੰਦ ਵਗੈਰਾ ਰਹਿੰਦੀ ਹੈ ਹਜੇ ਪੂਰੀ ਹੂੰ ਹੂੰ ਨਹੀਂ ਨਹੀਂ ਹਜੇ ਤੁਸੀਂ ਰ ਉਹ ਲੈ ਲਓ ਮਤਲਬ ਜ਼ਿਆਦਾ ਨਹੀਂ ਮਹੀਨੇ ਕੁ ਲਈ ਲੈ ਲਓ ਕੱਪੜੇ ਫਿਰ ਬਾਅਦ 'ਚ ਸਮਰਸ ਵੀ ਆਉਣ ਉਨ੍ਹਾਂ 'ਚ ਤੁਹਾਡੇ ਕੱਪੜੇ ਹੈ ਹੀ ਆ ਹਾਂਜੀ ਹਾਂਜੀ ਅੱਛਾ ਜੀ ਹੋਰ ਸਟੱਡੀ ਵਧੀਆ ਲੱਗੀ ਕਿੰਨੇ ਦਿਨ ਹੋ ਗਏ ਤੁਹਾਨੂੰ ਕੋਲੇਜ ਜਾਂਦਿਆਂ ਨੂੰ

ਹਾਂਜੀ ਹਾਂਜੀ ਮੈਂ ਤੁਹਾਨੂੰ ਪਹਿਲੀ ਵਾਰ ਮਿਲੀ ਮਿਲੀ ਵੀ ਨਹੀਂ ਹਜੇ ਤਾਂ ਥੋੜ੍ਹਾ ਹੁੰਦਾ

ਠੀਕ ਹੈ ਹਾਂਜੀ ਮੇਰੇ ਦੋ ਭੈਣ ਭਰਾ ਛੋਟੇ ਹੀ ਹੈ ਮੈਂ ਵੱਡੀ ਹਾਂ ਸਾਰਿਆਂ ਤੋਂ ਨਹੀਂ ਇੱਕ ਹੈ ਪਲੱਸ ਟੂ 'ਚ ਇੱਕ ਟੈਨਥ 'ਚ ਅਤੇ ਤੁਸੀਂ ਇੱਥੇ ਇਕੱਲੇ ਹੀ ਆਏ ਹੈ ਚਲ ਕੋਰਟ ਦੇ ਨੇੜੇ ਕੋਈ ਪੀ ਜੀ ਵਗੈਰਾ 'ਚ ਹੈ ਨਾ ਠੀਕ ਹੈ ਅਤੇ ਵਧੀਆ ਲੱਗੀ ਪੀ ਜੀ ਠੀਕ ਹੈ ਅੱਛਾ ਅੱਛਾ ਅਤੇ ਰੇਟਸ ਵਗੈਰਾ ਕਿੰਨੇ ਹੈ ਅੱਛਾ ਚਲੋ ਵਧੀਆ ਵਾਲਾ ਓਪਰਾ ਜਿਹਾ ਨਾ ਫੀਲ ਹੋਵੇ ਹਾਂਜੀ ਅਤੇ ਰੇਟਸ ਵਗੈਰਾ ਕਿੱਦਾਂ ਕਮਰੇ ਦਾ ਇੱਕ ਦਾ ਠੀਕ ਹੈ ਸਹੀ ਹੈ ਵੈਸੇ ਤਾਂ ਬਾਕੀ ਸਾਫ਼ ਸਫ਼ਾਈ ਚਲੋ ਠੀਕ ਹੈ ਜੀ ਓਕੇ ਬਾਏ ਬਾਏ